ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਸਿੱਖਿਆ ਦੀ ਕੁਆਲੀਟੀ ਬਹੁਤ ਹੀ ਜ਼ਿਆਦਾ ਹੈ ਪੰਜਾਬ ਦੇ ਵਿੱਚ ਬਹੁਤ ਹੀ ਮਸ਼ਹੂਰ ਵਿੱਦਿਅਕ ਸੰਸਥਾਵਾਂ ਹਨ ਜਿਵੇਂ ਕਿ ਥਾਪਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅਤੇ ਹੋਰ ਵੀ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਜਿਵੇਂ ਕਿ ਡਾਇਟਸ ਜਿਨ੍ਹਾਂ ਦੇ ਵਿੱਚ ਜਿਹੜੇ ਸਾਡੇ ਹੋਣ ਵਾਲੇ ਅਧਿਆਪਕ ਨੇ ਈ ਟੀ ਟੀ ਅਧਿਆਪਕ ਨੇ ਉਹ ਸਿੱਖਿਆ ਪ੍ਰਾਪਤ ਕਰਦੇ ਨੇ ਬਹੁਤ ਹੀ ਵਧੀਆ ਕਾਲਜ਼ ਜਿਵੇਂ ਮਹਿੰਦਰਾ ਕਾਲਜ਼ ਵਿਕਰਮ ਕਾਲਜ ਮੋਦੀ ਕਾਲਜ਼ ਰਣਵੀਰ ਕਾਲਜ਼ ਰਿਪੁਦਮਨ ਕਾਲਜ਼ ਬਹੁਤ ਹੀ ਉੱਦਮ ਤਰੀਕੇ ਦੀ ਜਿਹੜੀ ਜੋ ਵਿੱਦਿਆ ਹੈ ਉਹ ਪ੍ਰਦਾਨ ਕਰਦੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਈ ਮੈਡੀਕਲ ਕਾਲਜ਼ ਜਿਵੇਂ ਕਿ ਰਜਿੰਦਰਾ ਹੋਸਪਿਟਲ ਰਜਿੰਦਰਾ ਮੈਡੀਕਲ ਸ਼੍ਰੀ ਗੁਰੂ ਨਾਨਕ ਦੇਵ ਕਾਲਜ਼ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ